ਉੱਨੀ ਦਸ ਉੱਨੀ ਸੌ ਸਤਾਨਵੇਂ ਪੰਜ ਜਨਵਰੀ ਉੱਨੀ ਸੌ ਬਾਈ ਸੱਤ ਮਾਰਚ ਦੋ ਹਜ਼ਾਰ ਤਿੰਨ ਅੱਠ ਮਈ ਉੱਨੀ ਸੌ ਨੜ੍ਹਿਨਵੇਂ ਨੌ ਉੱਨੀ ਜੂਨ ਦੋ ਹਜ਼ਾਰ ਇੱਕ